ਵੱਧਦੀ ਆਬਾਦੀ ਕਰਕੇ ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿਹਤ ਦੇ ਖੇਤਰ ਦੇ ਵਿੱਚ ਕਿਉਂਕਿ ਪੰਜਾਬ ਦਾ ਇਲਾਕਾ ਬਹੁਤ ਬੜਾ ਹੈ ਹਰ ਜਗ੍ਹਾ ਸਿਹਤ ਸੇਵਾਵਾਂ ਦੇਣੀਆਂ ਪ੍ਰਸ਼ਾਸਨ ਨੂੰ ਬੜੀ ਮੁਸ਼ਕਿਲ ਆ ਰਹੀ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪ੍ਰਸ਼ਾਸਨ ਹੁਣ ਛੋਟੇ ਛੋਟੇ ਕਲੀਨਿਕ ਖੋਲ੍ਹ ਰਿਹਾ ਹੈ ਤਾਂ ਜੋ ਆਮ ਆਦਮੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾ ਸਕੇ